ਸਤਿ ਸ਼੍ਰੀ ਅਕਾਲ ਜੀ ਅੰਮ੍ਰਿਤਸਰ ਦੇ ਅੰਦਰ ਜਿਹੜਾ ਹੈਗਾ ਵਾ ਆਪਣਾ ਦਰਬਾਰ ਸਾਹਿਬ ਉਹ ਜਿਹੜੀ ਆ ਜਗ੍ਹਾ ਧਾਰਮਿਕ ਸਥਾਨ ਮੰਨਿਆ ਗਿਆ ਆ ਵੈਸੇ ਤਾਂ ਜਿਹੜਾ ਹੈਗਾ ਵਾ ਆਪਣਾ ਅ ਦਰਬਾਰ ਸਾਹਿਬ ਇੱਥੇ ਤਾਂ ਹਰ ਮੌਸਮ ਰੁੱਤ ਭਰ ਦੇਖੀ ਨਹੀਂ ਜਾਂਦੀ ਇੱਥੇ ਤਾਂ ਜਦੋਂ ਜਾਓ ਉਦੋਂ ਹੀ ਮਤਲਬ ਸੈਲਾਨੀ ਆਏ ਹੁੰਦੇ ਆ ਦਰਸ਼ਨ ਕਰਨ ਨੂੰ ਅਤੇ ਪਰ ਜ਼ਿਆਦਾਤਰ ਜਿਹੜੀ ਹੈਗੀ ਹੈ ਜਨਤਾ ਉਹ ਹੁੰਦੀ ਆ ਆਪਣਾ ਛੁੱਟੀਆਂ ਦੇ ਟਾਈਮ ਕੁਛ ਪੇਰੈਂਟਸ ਇੱਦਾਂ ਦੇ ਹੁੰਦੇ ਜਿਹੜੇ ਮਤਲਬ ਕੁਛ ਡ ਉਡੀਕਦੇ ਆ ਕਿ ਅਸੀਂ ਆਪਣਿਆਂ ਬੱਚਿਆਂ ਨਾਲ ਜਾਵਾਂਗੇ ਅਤੇ ਫਿਰ ਉਹ ਬੱਚਿਆਂ ਨੂੰ ਦਰਬਾਰ ਸਾਹਿਬ ਦਿਖਾਉਣ ਆਉਂਦੇ ਆ ਅਤੇ ਹੋਰ ਵੀ ਆਪਣੇ ਅੰਮ੍ਰਿਤਸਰ 'ਚ ਬਹੁਤ ਘੁੰਮਣ ਵਾਲੀਆਂ ਜਮਾ ਜਗ੍ਹਾਵਾਂ ਹੈਗੀਆਂ ਜਿੱਦਾਂ ਜਲ੍ਹਿਆਂਵਾਲਾ ਬਾਗ ਹੋ ਗਿਆ ਅਟਾਰੀ ਬੋਡਰ ਹੋ ਗਿਆ ਫਿਰ ਮਤਲਬ ਇੱਦਾਂ ਲੈ ਕੇ ਆਉਂਦੇ ਆ ਛੁੱਟੀਆਂ 'ਚ ਅਤੇ ਫਿਰ ਉਹਨਾਂ ਨੂੰ ਪੂਰਾ ਲਾਗੇ ਬੰਨੇ ਦਿਖਾਉਂਦੇ ਆ ਦੁਰਗਿਆਨਾ ਮੰਦਰ ਹੋ ਗਿਆ ਸੀਤਲਾ ਮੰਦਰ ਅਤੇ ਦਰਬਾਰ ਸਾਹਿਬ ਹੋਰ ਵੀ ਇੱਦਾਂ ਦੀਆਂ ਜਗ੍ਹਾਵਾਂ 'ਤੇ ਪਰੇਡ ਤਾਂ ਬਹੁਤ ਮੈਂ ਕਹਿੰਦੀ ਕਮਾਲ ਦੀ ਹੁੰਦੀ ਆ ਦੇਖਣ ਵਾਲੀ ਹੁੰਦੀ ਆ ਬੋਡਰ ਦੀ ਮਜ਼ਾ ਆ ਜਾਂਦਾ ਦੇਖ ਕੇ